ਸਰ ਮੈਂ ਆਪਣਾ ਐਕਸਪੀਰੀਅੰਸ ਸ਼ੇਅਰ ਕਰ ਰਹੀ ਹਾਂ ਮੈਂ ਬਹੁਤ ਜ਼ਿਆਦਾ ਹੈਡਫੋਨ ਯੂਜ਼ ਕਰਦੀ ਸੀ ਜਿਵੇਂ ਮੈਂ ਬੱਸ 'ਚ ਟਰੈਵਲ ਕਰਦੀ ਹਾਂ ਤਾਂ ਮੈਂ ਬਸ ਮਤਲਬ ਖੜ੍ਹ ਖੜ੍ਹ ਕੇ ਜਿੰਨਾ ਵੀ ਚਿਰ ਮਤਲਬ ਮੈਂ ਬੱਸ 'ਚ ਬੈਠਣਾ ਮੈਂ ਹੈਡਫੋਨ ਲਾ ਲੈਣੇ ਮਤਲਬ ਸਰ ਜਦੋਂ ਘਰਾਂ ਵੀ ਕੋਈ ਮਤਲਬ ਰੀਲਸ ਵਗੈਰਾ ਦੇਖਣੀ ਹੈ ਕੁਝ ਵੀ ਮਤਲਬ ਫੋਨ ਚਲਾਉਣਾ ਏ ਤਾਂ ਮੈਂ ਹੈਡਫੋਨ ਯੂਜ਼ ਕਰਦੀ ਸੀਗੀ ਤਾਂ ਉਹਨਾਂ ਨਾਲ਼ ਮੈਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ ਉਹਦੇ ਨਾਲ਼ ਮੇਰੇ ਕੰਨਾਂ ਨੂੰ ਸੁਣਨਾ ਬੰਦ ਹੋ ਗਿਆ ਸੁਣਦਾ ਤਾਂ ਸੀਗਾ ਮਤਲਬ ਸਰ ਮਤਲਬ ਜਿਹੜੀ ਚੀਜ਼ ਸਾਨੂੰ ਬਰੀਕੀ ਵਾਲੀ ਗੱਲਾਂ ਏ ਉਹ ਸਾਨੂੰ ਨਹੀਂ ਸੁਣਦੀਆਂ ਸੀਗੀਆਂ ਅਤੇ ਸਾਨੂੰ ਮੈਨੂੰ ਮਤਲਬ ਦਿੱਕਤ ਆਉਣ ਲੱਗ ਗਈ ਸੀਗੀ ਵੀ ਮਤਲਬ ਮੈਨੂੰ ਘੱਟ ਸੁਣਨ ਲੱਗ ਗਿਆ ਸੀਗਾ ਮੈਨੂੰ ਬਹੁਤ ਪ੍ਰੋਬਲਮਸ ਆਈਆਂ ਕਿਉਂਕਿ ਜਦੋਂ ਆਪਾਂ ਲਗਾਤਾਰ ਲਗਾ ਕੇ ਰੱਖਦੇ ਹਾਂ ਨਾ ਹੈਡਫੋਨ ਤਾਂ ਅਸੀਂ ਬਾਹਰ ਦਾ ਕੁਝ ਸੁਣ ਨਹੀਂ ਪਾਉਂਦੇ ਜਦੋਂ ਆਪਾਂ ਉਹ ਕਾਫ਼ੀ ਜ਼ਿਆਦਾ ਮੈਨੂੰ ਆਦਤ ਸੀ ਕਿ ਮੈਂ ਉੱਚੀ ਵੋਲੀਅਮ 'ਚ ਸੁਣਦੀ ਸੀਗੀ ਸੌਂਗ ਵੀ ਇਸ ਕਰਕੇ ਨਾ ਮੈਨੂੰ ਬਾਹਰ ਦਾ ਕੁਝ ਨਹੀਂ ਸੀ ਸੁਣਦਾ ਇਸ ਕਰਕੇ ਮੈਨੂੰ ਇਹ ਜ਼ਿਆਦਾ ਦਿੱਕਤ ਆਈ ਜਦੋਂ ਮਤਲਬ ਕਿ ਕੋਈ ਮੈਨੂੰ ਬੋਲਦਾ ਸੀ ਤਾਂ ਮੈਨੂੰ ਸ ਆਵਾਜ਼ ਸੁਣਾਈ ਦਿੰਦੀ ਸੀਗੀ ਬਟ ਮੈਨੂੰ ਜਿਹੜੀ ਐਗਜ਼ੈਕਟ ਗੱਲ ਹੈ ਬਰੀਕੀ ਵਾਲੀ ਗੱਲ ਥੋੜ੍ਹੀ ਜਿਹੀ ਉਹ ਮਤਲਬ ਸਲੋਅ ਬੋਲ ਦਿੰਦੇ ਸੀ ਮੈਨੂੰ ਉਹ ਸੁਣਾਈ ਨਹੀਂ ਦਿੰਦੀ ਸੀ ਇਸ ਕਰਕੇ ਮੈਂ ਸਾਰਿਆਂ ਨੂੰ ਇਹੀ ਰੇਕਮੈਂਡ ਕਰਾਂਗੀ ਕਿ ਹੈਡਫੋਨ ਯੂਜ਼ ਕਰੋ ਮੈਂ ਇਹ ਨਹੀਂ ਕਹਿੰਦੀ ਯੂਜ਼ ਨਾ ਕਰੋ ਬਟ ਉਹਨੂੰ ਘੱਟ ਯੂਜ਼ ਕਰੋ